ਪੰਦਰਾਂ ਮਈ ਉੱਨੀ ਸੌ ਪੰਝੱਤਰ ਵੀਹ ਅਗਸਤ ਉੱਨੀ ਸੌ ਛੱਬੀ ਪੰਦਰਾਂ ਜੁਲਾਈ ਦੋ ਹਜ਼ਾਰ ਸੱਤ ਤੇਰਾਂ ਜੁਲਾਈ ਦੋ ਹਜ਼ਾਰ ਨੌ ਵੀਹ ਅਗਸਤ ਉੱਨੀ ਸੌ ਪੰਝੱਤਰ